ਮੈਂ ਜਦੋਂ ਸਰਦੀਆਂ ਦੇ ਵਿੱਚ ਅਸੀਂ ਸਰਦੀਆਂ ਦੇ ਵਿੱਚ ਜਦੋਂ ਸਫ਼ਰ ਕਰਦੇ ਹਾਂ ਅਤੇ ਸਾਨੂੰ ਬਹੁਤ ਧੁੰਦਾਂ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਟ੍ਰੇਨ ਟ੍ਰੇਨਾਂ ਵੀ ਇੰਨੀਆਂ ਲੇਟ ਹੁੰਦੀਆਂ ਨੇ ਚਾਰ ਪੰਜ ਘੰਟੇ ਟ੍ਰੇਨਾਂ ਨਹੀਂ ਆਉਂਦੀਆਂ ਸਾਨੂੰ ਕਿੰਨੀ ਕਿੰਨੀ ਦੇਰ ਸਟੇਸ਼ਨਾਂ 'ਤੇ ਵੇਟ ਕਰਨੀ ਪੈਂਦੀ ਹੈ ਫਿਰ ਜੇ ਤਾਂ ਅਸੀਂ ਕੰਮ ਦੇ ਸਿਲਸਿਲੇ ਦੇ ਵਿੱਚ ਕਿਤੇ ਬਾਹਰ ਜਾਦੇ ਹਾਂ ਸਵੇਰੇ ਸਾਨੂੰ ਪਹਿਲਾਂ ਤਾਂ ਚਾਰ ਸਾਢੇ ਚਾਰ ਵਜੇ ਉੱਠਣਾ ਪੈਂਦਾ ਉੱਠ ਕੇ ਪਹਿਲਾਂ ਬੱਚੇ ਸਕੂਲ ਜਾਣ ਵਾਲੇ ਹੋਣ ਤਾਂ ਬੱਚਿਆਂ ਦਾ ਵੀ ਸਾਰਾ ਕੰਮ ਕਰਕੇ ਫਿਰ ਉਸ ਤੋਂ ਬਾਅਦ ਅਸੀਂ ਟ੍ਰੇਨ ਫੜਨੀ ਹੁੰਦੀ ਉੱਥੇ ਜਾ ਕੇ ਦੇਖੀਦਾ ਕਿ ਸਰਦੀ ਦੀ ਮੌਸਮ ਦੇ ਵਿੱਚ ਟ੍ਰੇਨ ਬਹੁਤ ਜ਼ਿਆਦਾ ਲੇਟ ਹੈ ਫਿਰ ਅਸੀਂ ਲੇਟ ਪਹੁੰਚੀਦਾ ਫਿਰ ਸਾਨੂੰ ਰਸਤੇ 'ਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਫਿਰ ਅੱਗੋਂ ਕਿਸੇ ਸ਼ਹਿਰ ਵਿੱਚ ਅਸੀਂ ਜਾਣਾ ਹੋਵੇ ਤਾਂ ਉੱਥੇ ਅਸੀਂ ਪਹਿਲਾਂ ਲੇਟ ਪਹੁੰਚੀਦਾ ਫਿਰ ਅੱਗੋਂ ਅਸੀਂ ਟਰੈਵਰਿੰਗ ਫਿਰ ਬਸ ਕਰਨੀ ਹੋਵੇ ਫਿਰ ਅਸੀਂ ਸਾਨੂੰ ਬੜੀ ਲੇਟ ਬਸ ਮਿਲਦੀ ਹੈ ਫਿਰ ਉਸ ਤੋਂ ਅੱਗੇ ਅਸੀਂ ਦੂਸਰੇ ਸ਼ਹਿਰ ਜਾਣਾ ਉਹ ਵੀ ਸਾਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਫਿਰ ਅਸੀਂ ਬੜੀ ਮੁਸ਼ਕਿਲ ਆਪਣਾ ਕੰਮ ਕਰਕੇ ਮਾਰਕੀਟ ਕਰਕੇ ਉਸ ਤੋਂ ਬਾਅਦ ਸਾਨੂੰ ਸ਼ਾਮ ਨੂੰ ਟ੍ਰੇਨ ਫਿਰ ਫੜਨੀ ਹੁੰਦੀ ਹੈ ਜੇ ਚਾਰ ਵਜੇ ਦੀ ਟ੍ਰੇਨ ਹੈ ਤਾਂ ਪੰਜ ਸਾਢੇ ਪੰਜ ਸਾਨੂੰ ਵੱਜ ਜਾਂਦੇ ਨੇ ਇੰਨੀ ਮੁਸ਼ਕਿਲ ਟ੍ਰੇਨ ਫੜ ਕੇ ਫਿਰ ਰਸਤੇ ਦੇ ਵਿੱਚ ਵੀ ਭੀੜ ਭੜੱਕਾ ਮੌਸਮ ਖ਼ਰਾਬ ਕਦੀ ਸਹੀ ਇੰਨੀ ਮੁਸ਼ਕਿਲਾਂ ਦੇ ਨਾਲ ਦਾ ਸਾਹਮਣਾ ਕਰਨਾ ਪੈਂਦਾ ਫਿਰ ਕਿਤੇ ਗੱਡੀ ਪਹਿਲਾਂ ਤਾਂ ਇੰਨੀ ਲੇਟ ਲੁਧਿਆਣਾ ਪਹੁੰਚੇਗੀ ਫਿਰ ਅਸੀਂ ਦੇਖੀਦਾ ਜੀ ਹੁਣ ਇਹ ਅੱਗੇ ਜਲੰਧਰ ਕਦੋਂ ਪਹੁੰਚੇਗੀ ਸਾਰੇ ਰਸਤੇ ਕਰਦੇ ਕਰਦੇ ਬੜੀ ਮੁਸ਼ਕਿਲ ਅਸੀਂ ਅੰਮ੍ਰਿਤਸਰ ਤੱਕ ਮਸਾਂ ਹੀ ਪਹੁੰਚ ਪਾਉਂਦੇ ਹਾਂ ਉਹ ਵੀ ਧੁੰਦਾ ਕਰਕੇ ਇੰਨੀ ਲੇਟ ਗੱਡੀ ਜਿਹੜੀ ਦਸ ਵਜੇ ਆਉਣੀ ਹੈ ਸਾਨੂੰ ਬਾਰਾਂ ਇੱਕ ਐਵੇਂ ਵੱਜ ਜਾਂਦਾ ਪਹੁੰਚਦੇ ਪਹੁੰਚਦੇ ਰਾਤ ਅਸੀਂ ਫਿਰ ਲੇਟ ਉ ਸੋਣਾ ਸਵੇਰੇ ਫਿਰ ਮੋਰਨਿੰਗ ਦੇ ਵਿੱਚ ਫਿਰ ਸਾਨੂੰ ਜਲਦੀ ਤੜਕੇ ਹੀ ਜਾਣਾ ਪੈਂਦਾ